ਮੈਂ ਔਨਲਾਈਨ ਸ਼ੋਪਿੰਗ ਕਰਦਾ ਹੀ ਰਹਿੰਦਾ ਹਾਂ ਮੈਂ ਕਾਫ਼ੀ ਸਾਈਡ ਤੋਂ ਸ਼ੋਪਿੰਗ ਕਰਦਾ ਹਾਂ ਪਰ ਐਮਾਜ਼ੋਨ ਦੀ ਸਰਵਿਸ ਮੈਨੂੰ ਬਹੁਤ ਚੰਗੀ ਲੱਗੀ ਹੈ ਉਹ ਪੂਰੇ ਟਾਈਮ 'ਤੇ ਸਮਾਨ ਪਹੁੰਚਾਉਂਦੇ ਰਹਿੰਦੇ ਹਨ ਉਹਨਾਂ ਦਾ ਡਿਲੀਵਰੀ ਬੋਆਏ ਵੀ ਕਾਫ਼ੀ ਚੰਗੇ ਹਨ ਮੈਂ ਉਹਨਾਂ ਤੋਂ ਮੋਬਾਇਲ ਮੰਗਵਾ ਮੰਗਾਇਆ ਸੀ ਉਹ ਬਹੁਤ ਹੀ ਵਧੀਆ ਹੈ ਬਹੁਤ ਹੀ ਵਧੀਆ ਹੈ ਕਦੇ ਗਰਮ ਨਹੀਂ ਹੁੰਦਾ ਨਾ ਕਦੇ ਹੈਂਗ ਹੁੰਦਾ ਹੈ ਇਸ ਦਾ ਕੈਮਰਾ ਵੀ ਬਹੁਤ ਵਧੀਆ ਚੱਲਦਾ ਹੈ ਬੈਟਰੀ ਬੈਕਅੱਪ ਵੀ ਬਹੁਤ ਵਧੀਆ ਹੈ